ਪੰਜਾਬ ਵਿੱਚ ਮਨਾਏ ਜਾਣ ਵਾਲੇ ਮੁੱਖ ਸੱਭਿਆਚਾਰਕ ਤਿਉਹਾਰ ਜਾਂ ਸਮਾਗਮ ਬਹੁਤ ਤਰ੍ਹਾਂ ਦੇ ਨੇ ਜਿਵੇਂ ਕਿ ਆਪਾਂ ਗੱਲ ਕਰੀਏ ਪਹਿਲਾਂ ਵਿਸਾਖੀ ਜੋ ਵਿਸਾਖ ਦੇ ਵਿੱਚ ਸ਼ੁਰੂ ਹੁੰਦੀ ਹੈ ਤੇਰ੍ਹਾਂ ਅਪ੍ਰੈਲ ਨੂੰ ਇਹ ਮਨਾਈ ਜਾਂਦੀ ਹੈ ਇਹ ਇੱਕ ਹਾੜੀ ਫਸਲ ਦੀ ਖੁਸ਼ੀ ਦੇ ਵਿੱਚ ਮਨਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹੋਲਾ ਮਹੱਲਾ ਜਿਹੜਾ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਜਿਹਦੇ ਵਿੱਚ ਲੋਕ ਬੜੇ ਇੱਕ ਦੂਜੇ 'ਤੇ ਰੰਗ ਪਾਉਂਦੇ ਨੇ ਢਾਡੀ ਕਵੀਸ਼ਰ ਲੱਗੇ ਹੁੰਦੇ ਨੇ ਗੁਰਦੁਆਰਿਆਂ ਦੇ ਵਿੱਚ ਹੋਲੀ ਹੋਲੀ ਵੀ ਪੰਜਾਬ ਦੇ ਵਿੱਚ ਮਨਾਈ ਜਾਂਦੀ ਆ ਜਿਹਨਾਂ ਨੇ ਇੱਕ ਦੂਜੇ ਦੀ ਭਾਈਚਾਰਕ ਸਾਂਝ ਬਹਿੰਦੀ ਹੈ ਲੋਕ ਇੱਕ ਦੂਜੇ 'ਤੇ ਰੰਗ ਪਾਉਂਦੇ ਨੇ ਜਿਵੇਂ ਇੱਕ ਲੋਹੜੀ ਲੋਹੜੀ ਸਰਦੀ ਦੇ ਰੁੱਤ ਦੇ ਵਿੱਚ ਮਨਾਈ ਜਾਂਦੀ ਹੈ ਜਿਵੇਂ ਕਿ ਲੋਹੜੀ ਵੈਸੇ ਤਾਂ ਇਤਿਹਾਸਿਕ ਤਾਂ ਇਹ ਦੁੱਲਾ ਭੱਟੀ ਦੇ ਨਾਲ ਸੰਬੰਧਿਤ ਹੈ ਜਿਹੜਾ ਕਿ ਇੱਕ ਡਾਕੂ ਸੀਗਾ ਪਰ ਉਹ ਗਰੀਬ ਕੁੜੀਆਂ ਦੇ ਵਿਆਹ ਕਰ ਦਿੰਦਾ ਸੀ ਉਹ ਜੋ ਪੈਸੇ ਵੀ ਲੁੱਟਦਾ ਸੀ ਉਹਨਾਂ ਨਾਲ ਇਹ ਸਰਦੀ ਦੀ ਰੁੱਤ ਦੇ ਵਿੱਚ ਮਨਾਈ ਜਾਂਦੀ ਹੈ ਜਿਹੜੀ ਲੋਹੜੀ ਆ ਉਹ ਤੋਂ ਬਾਅਦ ਇੱਕ ਮੁਕਤਸਰ ਸਾਹਿਬ ਵਿਖੇ ਮੁਕਤਸਰ ਸਾਹਿਬ ਵਿਖੇ ਮੇਲਾ ਲੱਗਦਾ ਜਿਹਨੂੰ ਆਪਾਂ ਕਹਿੰਦੇ ਹਾਂ ਮਾਘੀ ਦਾ ਮੇਲਾ ਉਹ ਚਾਲ੍ਹੀ ਮੁਕਤਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜਿਆ ਸੀਗਾ ਉਹਦੇ ਵਿੱਚ ਮਨਾਇਆ ਜਾਂਦਾ ਗਾ